ਹਾਂਜੀ ਹਾਂਜੀ ਫ਼ਰਨੀਚਰ ਵਾਲੀ ਸ਼ੋਪ ਤੋਂ ਹੀ ਬੋਲਦੇ ਹਾਂ ਹਾਂਜੀ ਕਦੋਂ ਲੈ ਕੇ ਗਏ ਸੀਗੇ ਹਾਂਜੀ ਹਾਂਜੀ ਅੱਛਾ ਜੀ ਕੀ ਪ੍ਰੋਬਲਮ ਆਉਂਦੀ ਹੈ ਜੀ ਹਾਂਜੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਉਹ ਤੁਸੀਂ ਸ਼ੋਪ 'ਤੇ ਆ ਜੋ ਜੇ ਅਸੀਂ ਬਦਲ ਕੇ ਦੇ ਦਾਂਗੇ ਹੋਰ ਕੋਈ ਜੀ ਦਿੱਕਤ ਬੈੱਡ ਵੱਲੋਂ ਹਾਂਜੀ ਆਪਣੇ ਕਾਫ਼ੀ ਡਿਜ਼ਾਈਨ ਪਏ ਹੈਗੇ ਉਹ ਤਾਂ ਡਿਜ਼ਾਈਨ ਦੇਖਣਾ ਪੈਣਾ ਜੇ ਹੋਰ ਹੈਗਾ ਤਾਂ ਕੋਈ ਗੱਲ ਨਹੀਂ ਅਸੀਂ ਐਕਸਚੇਂਜ ਕਰ ਦਾਂਗੇ ਹਾਂਜੀ ਬਣਵਾ ਵੀ ਸਕਦੇ ਹੈ ਤੁਸੀਂ ਵੈਸੇ ਤਾਂ ਫਿਲਹਾਲ ਸਾਡੇ ਸ਼ੋਰੂਮ 'ਚ ਕਾਫ਼ੀ ਸਾਰੇ ਬੈੱਡ ਪਏ ਹੈਗੇ ਅਤੇ ਆਪਾਂ ਉਹਦੇ ਵਿੱਚ ਡਿਜ਼ਾਈਨ ਦੇਖ ਲਾਂਗੇ ਬਹੁਤ ਵੱਡੇ ਵੱਡੇ ਬੈੱਡ ਪਏ ਆ ਅਤੇ ਜੇ ਉਹ ਤੁਹਾਨੂੰ ਸਹੀ ਲੱਗੇ ਤਾਂ ਤੁਸੀਂ ਉਹ ਖ਼ਰੀਦ ਸਕਦੇ ਹਾਂ ਜਿਵੇਂ ਤੁਹਾਨੂੰ ਠੀਕ ਲੱਗਦਾ ਗਾ ਅਸੀਂ ਡਿਜ਼ਾਇਨ ਦਿਖਾ ਦਾਂਗੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਅਸੀਂ ਅੱਗੇ ਤੋਂ ਧਿਆਨ ਰੱਖਾਂਗੇ ਵਧੀਆ ਲੱਕੜ ਦੇਵਾਂਗੇ ਅੱਗੇ ਤੋਂ ਪੂਰਾ ਧਿਆਨ ਰੱਖਾਂਗੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਹਾਂਜੀ ਵਧੀਆ ਮਿਲਣਗੇ ਆਪਣੇ ਵਧੀਆ ਕੁਐਲਟੀ ਦੇ ਡਰੈਸ ਟੇਬਲ ਸੋਫ਼ੇ ਅਲਮੀਰਾ ਵਾਧੂ ਕੁਛ ਪਿਆ ਆਪਣੇ ਸ਼ੋਪ 'ਚ ਅਤੇ ਹਾਂਜੀ ਹਾਂਜੀ ਅਲਮੀਰਾ ਦੇਖੋ ਦੇਖ ਹੈ ਐਲੂਮੀਨੀਅਮ ਦੀ ਹੈਗੀ ਹੈ ਲੱਕੜ ਦੀ ਹੈਗੀ ਹੈ ਹਾਂਜੀ ਅਲੱਗ ਅਲੱਗ ਤਰ੍ਹਾਂ ਦੀਆਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਵਧੀਆ ਲੱਕੜ ਦੀ ਮਜ਼ਬੂਤ ਅਲਮੀਰਾ ਮਿਲੂਗੀ ਤੁਹਾਨੂੰ ਠੀਕ ਹਾਂਜੀ ਕੋਈ ਗੱਲ ਨਹੀਂ ਤੁਸੀਂ ਕੱਲ੍ਹ ਆ ਸਕਦੇ ਹੋ ਹਾਂਜੀ ਹਾਂਜੀ ਬਾਕੀ ਆਪਣੇ ਸ਼ੋਰੂਮ ਦੇ ਵਿੱਚ ਕੁਰਸੀਆਂ ਸੈਟੀਆਂ ਅਤੇ ਹੋਰ ਕਈ ਅਲੱਗ ਅਲੱਗ ਤਰ੍ਹਾਂ ਦਾ ਸਮਾਨ ਸੋਫ਼ੇ ਵਗੈਰਾ ਹਾਂਜੀ ਮਤਲਬ ਸਮਾਨ ਮਿਲਦਾ ਪ੍ਰੈਸ ਟੇਬਲ ਹੋ ਗਿਆ ਹੋ ਅਲਮੀਰਾ ਹੋ ਗਿਆ ਬੈੱਡ ਹੋ ਗਏ ਸੋਫ਼ੇ ਹੋ ਗਏ ਅਤੇ ਆਪਣੇ ਹੋ ਗਏ ਹਾਂਜੀ ਕੋਈ ਗੱਲ ਨਹੀਂ ਤੁਸੀਂ ਕੱਲ੍ਹ ਆ ਸਕਦੇ ਹੋ ਤੇ ਤੁਸੀਂ ਚੈੱਕ ਕਰ ਲਿਓ ਜੇ ਜਿਹੜੇ ਤੁਹਾਨੂੰ ਪਸੰਦ ਲੱਗੇ ਅਸੀਂ ਉਹ ਹੀ ਦੇ ਦਾਂਗੇ